ਮੈਂ ਇਹ ਸੋਚਦਾ ਹਾਂ ਕਿ ਨਵੇਂ ਜਨਮੇ ਬੱਚਿਆਂ ਨੂੰ ਇੱਕ ਸਵੱਛ ਵਾਤਾਵਰਨ ਦੇਣਾ ਬਹੁਤ ਜ਼ਰੂਰੀ ਹੈ ਤਾਂ ਜੋ ਉਹ ਕਈ ਬਿਮਾਰੀਆਂ ਤੋਂ ਬਚ ਸਕਣ ਬਹੁਤ ਸਾਰੀਆਂ ਬਿਮਾਰੀਆਂ ਐਸੀਆਂ ਹਨ ਜੋ ਬਚਪਨ ਤੋਂ ਹੀ ਬੱਚਿਆਂ ਨੂੰ ਲੱਗ ਜਾਂਦੀਆਂ ਹਨ ਅਤੇ ਸਾਰੀ ਉਮਰ ਉਹਨਾਂ ਦਾ ਪਿੱਛਾ ਨਹੀਂ ਛੱਡਦੀਆਂ ਇਸਦੇ ਕਈ ਉਪਾਅ ਹਨ ਕਿ ਨਵ ਜਨਮੇ ਬੱਚਿਆਂ ਨੂੰ ਇੱਕ ਸਵੱਛ ਵਾਤਾਵਰਨ ਕਿਵੇਂ ਦੇਣਾ ਹੈ ਜਿਵੇਂ ਕਿ ਸਾਰਿਆਂ ਦੀ ਆਦਤ ਹੁੰਦੀ ਹੈ ਕਿ ਨਵ ਜਨਮੇ ਬੱਚੇ ਨੂੰ ਆਪਣੀ ਗੋਦ ਵਿੱਚ ਚੁੱਕ ਕੇ ਟਚ ਕਰਨਾ ਜਾਂ ਉਹਨਾਂ ਦਾ ਮੱਥਾ ਚੁੰਮਣਾ ਜੋ ਕਿ ਬਹੁਤ ਗਲਤ ਗੱਲ ਹੈ ਇਹਦੇ ਨਾਲ ਆਪਣੇ ਮੂੰਹ ਦੇ ਕੀਟਾਣੂ ਉਸ ਦੀ ਸਕਿੰਨ 'ਤੇ ਲੱਗਦੇ ਹਨ ਅਤੇ ਬੱਚੇ ਦੀ ਸਕਿੰਨ ਬਹੁਤ ਸੋਫਟ ਹੁੰਦੀ ਹੈ ਅਤੇ ਇਸ ਕੰਡੀਸ਼ਨ ਵਿੱਚ ਨਹੀਂ ਹੁੰਦੀ ਕਿ ਉਹ ਵੱਖਰੇ ਵੱਖਰੇ ਡਿਸੀਸਿਜ਼ ਨਾਲ ਲੜ ਸਕਦੀ ਹੈ ਸੋ ਇੱਕ ਤਾਂ ਇਹ ਹੋ ਗਿਆ ਦੂਸਰਾ ਇਹ ਹੈ ਕਿ ਉਹਨਾਂ ਨੂੰ ਰੋਜ਼ ਨਵਾਉਣਾ ਵੀ ਬਹੁਤ ਗਲਤ ਗੱਲ ਹੈ ਉਹਨਾਂ ਦੀ ਬੋਡੀ ਇਸ ਟੈਂਪਰੇਚਰ ਲਈ ਐਡਜਸਟ ਨਹੀਂ ਹੋ ਸਕਦੀ ਸੋ ਉਹਨਾਂ ਨੂੰ ਦੋ ਤਿੰਨ ਚਾਰ ਦਿਨ ਦਾ ਗੈਪ ਦੇ ਕੇ ਨਵਾਉਣਾ ਚਾਹੀਦਾ ਹੈ ਤੁਸੀਂ ਇੱਕ ਗਿੱਲੀ ਟਾਕੀ ਨਾਲ ਉਹਨਾਂ ਦੀ ਬੋਡੀ ਸਾਫ਼ ਕਰ ਸਕਦੇ ਹੋ ਉਸ ਤੋਂ ਬਾਅਦ ਇਹ ਹੈ ਕਿ ਉਹਨਾਂ ਦੇ ਸਮੇਂ ਸਿਰ ਡਾਈਪਰ ਚੇਂਜ ਕਰਨੇ ਡਾਈਪਰ ਚੇਂਜ ਕਰਨ ਨਾਲ ਅਨੇਕ ਬਿਮਾਰੀਆਂ ਖ਼ਤਮ ਹੋ ਜਾਂਦੀਆਂ ਹਨ ਅਗਰ ਇੱਕੋ ਡਾਈਪਰ ਹੀ ਦੋ ਦੋ ਤਿੰਨ ਤਿੰਨ ਦਿਨ ਚੱਲੇਗਾ ਤਾਂ ਬਹੁਤ ਸਾਰੀ ਬਿਮਾਰੀਆਂ ਦਾ ਸਾਹਮਣਾ ਬੱਚਿਆਂ ਨੂੰ ਕਰਨਾ ਪਵੇਗਾ ਜਿਹਦੇ ਨਾਲ ਉਹ ਬਿਮਾਰ ਹੋਣ ਦਾ ਆਦੀ ਹੋ ਸਕਦਾ ਹੈ